ਚਾਰ ਲੱਖ ਪੰਜਾਹ ਹਜ਼ਾਰ ਪੰਜ ਲੱਖ ਵੀਹ ਹਜ਼ਾਰ ਛੇ ਲੱਖ ਤੀਹ ਹਜ਼ਾਰ ਸੱਤ ਲੱਖ ਚਾਲੀ ਹਜ਼ਾਰ ਅੱਠ ਲੱਖ ਬੱਤੀ ਹਜ਼ਾਰ